ਸਤਿ ਸ਼੍ਰੀ ਅਕਾਲ ਜੀ ਹਾਂਜੀ ਦੱਸੋ ਅੱਛਾ ਜੀ ਹਾਂਜੀ ਹਾਂਜੀ ਇੱਥੇ ਮਿਲਦੇ ਆ ਜੀ ਹਾਂਜੀ ਇੱਥੇ ਹੈਗਾ ਇੱਕ ਆਪਣੇ ਡਾਕੂਮੈਂਟ ਵੀ ਹੈਗਾ ਜੀ ਅੱਛਾ ਹਾਂਜੀ ਹੈਗੀਆਂ ਜੀ ਬਹੁਤ ਹੈਗੀਆਂ ਬਹੁਤ ਇੱਥੇ ਆਪਣੇ ਹਾਂਜੀ ਇੱਕ ਤਾਂ ਆਪਣੇ ਇੱਧਰ ਹੈਗੀ ਹੈ ਮੱਖੂ ਗੇਟ ਵੱਲ ਹੈਗੀ ਹੈ ਜੀ ਇਧਰਲੇ ਮੱਖੂ ਗੇਟ ਤਾਂ ਟਿੱਕੀ ਬਹੁਤ ਸੁਆਦ ਬਣਦੀ ਹੈ ਜੀ ਇੱਥੇ ਰਾਮੂ ਦੀ ਦੁਕਾਨ 'ਤੇ ਨਾ ਨਾਮ ਉਹਦਾ ਦੁਕਾਨ ਵਾਲੇ ਦਾ ਰਾਮੂ ਹੀ ਹੈ ਬੋ ਬਹੁਤ ਹੀ ਟੇਸਟੀ ਉਹ ਟਿੱਕੀ ਤਿਆਰ ਕਰਦਾ ਹਾਂ ਦੇਸੀ ਘਿਓ ਦੀ ਬਣਦੀ ਹੋਰ

ਹੋਰ ਵੀ ਆਪਣੇ ਇੱਧਰ ਹੈਗੀਆ ਇੱਕ ਇਧਰਲੇ ਦਿੱਲੀ ਗੇਟ ਵਾਲੇ ਪਾਸੇ ਆ ਜੀ ਹਾਂਜੀ ਉੱਧਰ ਹੈਗੀ ਹੈ ਦੁਕਾਨ ਗੁਲਸ਼ਨ ਦੀ ਹਾਂਜੀ ਹਾਂਜੀ ਕੋਲ ਖਲੋ ਕੇ ਤਿਆਰ ਬਰਗਰ ਤਾਜ਼ੇ ਤਾਜ਼ੇ ਉਸੇ ਵੇਲੇ ਰੇੜੀਆਂ ਤੋਂ ਵੀ ਮਿਲਦੇ ਆ ਆਮ ਹੀ ਸਾਰੇ ਬੂਟੇ ਦੀ ਰੇਹੜੀ ਤੋਂ ਵੀ ਮਿਲ ਜਾਏਗੀ ਉੱਧਰ ਵੀ ਹੈ ਬਹੁਤ ਬਹੁਤ ਹੀ ਟੇਸਟੀ ਹਾਂਜੀ ਹਾਂਜੀ ਹਾਂਜੀ ਪੀਜੇ ਦੀ ਦੁਕਾਨ ਹੈ ਇਧਰਲੀ ਸਾਈਡ ਨਹੀਂ ਹੈਗੀ ਪੀਜੇ ਦੀ ਜੀਰਾ ਗੇਟ ਵਾਲੇ ਪਾਸੇ ਹੈ ਜੀ ਹਾਂਜੀ ਉਹ ਉਧਰ ਹਾਂਜੀ ਬਹੁਤ ਵੱਡੀ ਦੁਕਾਨ ਹੈ ਸ਼ੀਸ਼ੇ ਸ਼ੁਸ਼ੇ ਲੱਗਾ ਹੋਇਆ ਬਹੁਤ ਸੋਹਣੀ ਦੁਕਾਨ ਬਣੀ ਹੋਈ ਹੈ ਹਾਂਜੀ ਬਰਗਰ ਵੀ ਹਰ ਇੱਕ ਜੋ ਵੀ ਹੈ ਹਰ ਇੱਕ ਚੀਜ਼ ਮਿਲਦੀ ਹੈ ਜੀ ਉੱਧਰ ਜੋ ਵੀ ਤੁਸੀਂ ਚਾਹੁੰਦੇ ਹੋਵੋਗੇ ਹਾਂਜੀ ਤੁਹਾਨੂੰ ਮਿਲ ਫ਼ਿਰੋਜ਼ਪੁਰ ਦਕਾਮ ਦਾ ਦੁਕਾਨ ਦਾ ਨਾਮ ਨਹੀਂ ਰੱਖਿਆ ਉਹਨਾਂ ਇਹ ਹੀ ਰੱਖਿਆ ਜਿਹੜਾ ਤੁਹਾਨੂੰ ਦੱਸਿਆ ਫਿਰੋਜ਼ਪੁਰੀ ਹਾਂ ਬਾਹਰਲੀ ਸਾਈਡ ਨਾ ਤੁਸੀਂ ਜਦੋਂ ਬਾਹਰਲੀ ਸਾਈਡ ਜਾਓਗੇ ਦੇਖੋਗੇ ਨਾ ਉਹ ਬੋਰਡ ਲੱਗਾ ਹੋਇਆ ਨਾਲ ਹੀ ਫ਼ਿਰੋਜ਼ਪੁਰ ਹੀ ਉੱਤੇ ਲਿਖਿਆ ਹੋਇਆ ਹਾਂਜੀ ਅਤੇ ਹੋਰ ਹੋਰ ਕਿਹੜੀ ਚੀਜ਼ ਚੈਨਲ ਦਾ ਨਾਮ ਦੱਸ ਦਿਓ ਤੁਹਾਡੇ ਅੱਛਾ ਜੀ ਫਿਰ ਅਸੀਂ ਵੀ ਤੁਹਾਡੀ ਵੀਡੀਓ ਵੇਖ ਸਕਾਂਗੇ ਜੀ ਲਾਈਕ ਏ ਲਾਈਕ ਕਰ ਦਿਆ ਕਰਾਂਗੇ ਜੀ ਹੋਰ ਹਾਂਜੀ ਹੋਰ ਕੇ ਤੁਸੀਂ ਕਿੱਥੋਂ ਆਏ ਚੰਡੀਗੜੋਂ ਆਏ ਜੇ ਅੱਛਾ ਜੀ ਕਿੰਨੀਆਂ ਵੀਡੀਓ ਬਣਾਉਣੀਆਂ ਤੁਸੀਂ ਅੱਛਾ ਅੱਛਾ ਅੱਛਾ ਜੀ ਅੱਛਾ ਠੀਕ ਹੈ ਜੀ ਪਰ ਤੁਸੀਂ ਅੱਛਾ ਅੱਛਾ ਕਿ ਉੱਧਰ ਦਾ ਮਹੌਲ ਤੁਹਾਨੂੰ ਕਿਸ ਤਰਰ੍ਹਾਂ ਲੱਗਿਆ ਮਹੌਲ ਫ਼ਿਰੋਜ਼ਪੁਰ ਦਾ ਕਿਵੇਂ ਲੱਗਿਆ ਤੁਸੀਂ ਦੇਖਿਆ ਤਾਂ ਅੱਛਾ ਜੀ ਅੱਛਾ ਹੋਰ ਹੋਰ ਵਧੀਆ ਵਧੀਆ ਚੀਜ਼ਾਂ ਮਿਲਦੀਆਂ ਤੁਸੀਂ ਵੀ ਹਾਂ ਵੇਖਲੀਆਂ ਅਤੇ ਹੋਰ ਕੋਈ ਵੀ ਚੀਜ਼ ਦੇਖਣੀ ਹੋਵੇ ਤਾਂ ਆਪਣੇ ਇੱਧਰਲੇ ਉਪਰ ਵੱਲ ਦੀ ਇੱਕ ਦੋ ਗੇਟ ਹੋਰ ਵੀ ਹੈਗੇ ਨੇ ਤੁਸੀਂ ਉੱਧਰ ਵੀ ਜਾ ਸਕਦੇ ਹਾਂਜੀ ਅੱਛਾ ਜੀ ਹਾਂਜੀ ਨੰਬਰ ਮੇਰਾ ਪੰਝੱਤਰ ਜੀਰੋ ਇਕਾਸੀ ਹੈ ਜੀ ਪੰਜਤਾਲੀ ਜੀਰੋ ਛਿਆਨਵੇਂ ਜੀ ਹਾਂਜੀ

ਹੋਰ ਕੋਈ ਸੇਵਾ ਦੱਸੋ ਜੀ ਹੋਰ ਆਪਣੇ ਚੈਨਲ ਦਾ ਤੁਸੀਂ ਆਪਣਾ ਨਾਮ ਦੱਸਤਾ ਹੈ ਅਸੀਂ ਤੁਹਾਡੀਆਂ ਵੀਡੀਓ ਦੇ